ਹੈਲੋ ਹਾਂਜੀ ਟੂਰਿਸਟ ਗਾਈਡ ਬੋਲ ਰਹੇ ਹੋ ਜੀ ਸਰ ਐਕਚੁਲੀ ਮੈਂ ਨਾ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਸਾਈਟਸ ਬਾਰੇ ਘੁੰਮ ਅਤੇ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਸੀਗਾ ਤੁਹਾਡਾ ਨਾਮ ਅਤੇ ਤੁਸੀਂ ਮੈਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਹਾਂਜੀ ਹਾਂਜੀ ਸਰ ਮੇਰੀ ਅਰਾਵਿੰਗ ਸਰ ਥਰਡ ਜਨਵਰੀ ਨੂੰ ਹੈ ਠੀਕ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਅੱਛਾ ਜੀ

ਠੀਕ ਹੈ ਠੀਕ ਹੈ ਜੀ ਠੀਕ ਹੈ ਸਰ ਅਤੇ ਸਰ ਤੁਹਾਡੇ ਚਾਰਜਸ ਕੀ ਰਹਿਣਗੇ ਵੈਸੇ ਠੀਕ ਹੈ ਜੀ ਸਰ ਵੈਸੇ ਤਾਂ ਇੱਕ ਹਫਤੇ ਦਾ ਪਲੈਨ ਹੈ ਬਟ ਉਹੀ ਹੈ ਨਾ ਸਾਈਟਸ ਕਵਰ ਕਰਨ ਮੈਨੂੰ ਕਿੰਨੇ ਦਿਨ ਲੱਗਣਗੇ ਉਹ ਤੁਸੀਂ ਹੁਣ ਦੱਸੋਗੇ ਹਾਂਜੀ ਠੀਕ ਹੈ ਸਰ ਠੀਕ ਹੈ ਜੀ ਓਕੇ ਸਰ ਮੈਂ ਐਕਚੁਲੀ ਆਪਣੀ ਫੈਮਲੀ ਨਾਲ ਡਿਸਕਸ ਕਰਕੇ ਨਾ ਫਿਰ ਤੁਹਾਨੂੰ ਇਨਫੋਰਮ ਕਰ ਦਾਂਗੀ ਜਿਵੇਂ ਵੀ ਸਾਡਾ ਪਲੈਨ ਹੋਇਆ ਠੀਕ ਹੈ ਓਕੇ ਸਰ ਥੈਂਕ ਯੂ